ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਹੈ ਸਰ ਹੋਰ ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਆਪਣਾ ਨਾ ਆਪਣਾ ਇੱਥੇ ਅੰਮ੍ਰਿਤਸਰ ਦੇ ਵਿੱਚ ਦੇਖੋ ਭਰਾਵਾਂ ਦਾ ਢਾਬਾ ਕਾਫੀ ਮਸ਼ਹੂਰ ਹੈ ਆਪਣਾ ਪਾਲੇ ਦਾ ਢਾਬਾ ਅਤੇ ਕੇਸਰ ਦਾ ਢਾਬਾ ਇਹ ਕਾਫੀ ਮਸ਼ਹੂਰ ਨੇ ਅਗਰ ਤੁਸੀਂ ਕੁਲਚਾ ਖਾਣਾ ਜੀ ਹਾਂ ਕੇਸਰ ਦਾ ਢਾਬਾ ਜੀ ਆਪਣਾ ਇੱਥੋਂ ਜਦੋਂ ਤੁਸੀਂ ਆਪਣਾ ਅੰਦਰ ਆਓਗੇ ਨਾ ਇੱਧਰੋਂ ਦੀ ਆਪਣਾ ਤੁਸੀਂ ਗੁਰੂ ਕੇ ਮਹਿਲ ਗੁਰਦੁਆਰਾ ਹੈਗਾ ਉੱਥੇ ਹਾਂ ਟਾਊਨ ਹਾਲ ਤੋਂ ਅੱਗੇ ਜਾ ਉੱਥੇ ਹਾਂ ਬਸ ਉਹਦੇ ਲਾਗੇ ਹੀ ਆਪਣਾ ਤੁਹਾਨੂੰ ਮਿਲ ਜਾਏਗਾ ਉੱਥੋਂ ਤੋਂ ਹਾਂ ਕਿ ਅੰਮ੍ਰਿਤਸਰ ਦੀ ਲੱਸੀ ਪੀਣਾ ਚਾਹੁੰਦੇ ਹੋ ਤਾਂ ਗਿਆਨੀ ਦੀ ਲੱਸੀ ਆ ਹਾਲ ਗੇਟ ਉਹ ਕਾਫੀ ਮਸ਼ਹੂਰ ਹੈ ਠੀਕ ਹੈ ਸਰ ਠੀ ਠੀਕ ਆ ਜੀ ਓਕੇ ਸਰ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ